ਮੈਨੂੰ ਖਾਣਾ ਪਕਾਉਣ ਦਾ ਬਹੁਤ ਹੀ ਵਧੀਆ ਸ਼ੌਂਕ ਹੈ ਅਤੇ ਮੈਂ ਜਦ ਕੋਈ ਪੂਰੀ ਛੋਲੇ ਬਣਾਉਂਦੀ ਹਾਂ ਤਾਂ ਪੂਰੀ ਬਣਾਉਣ ਲਈ ਕੜਾਈ ਦੀ ਵਰਤੋਂ ਕਰਦੀ ਹਾਂ ਅਤੇ ਜਦ ਕੋਈ ਸਬਜ਼ੀ ਕੱਟਦੀ ਹਾਂ ਤਾਂ ਉਹਦੇ ਲਈ ਚਾਕੂ ਦਾ ਵਰਤੋਂ ਕਰਦੀ ਹਾਂ ਜਿੱਦਾਂ ਜਦ ਚੌਲ ਬਣਾਉਂਗੇ ਤਾਂ ਕੁੱਕਰ ਦਾ ਵਰਤੋਂ ਕਰਦੇ ਹਾਂ ਅਤੇ ਮੈਨੂੰ ਖਾਣਾ ਬਣਾਉਣ ਦਾ ਬਹੁਤ ਹੀ ਜ਼ਿਆਦਾ ਸ਼ੌਂਕ ਹੈ ਅਤੇ ਜਦ ਵੀ ਮੇਰੀ ਛੁੱਟੀ ਹੁੰਦੀ ਹੈ ਜਾਂ ਮੈਂ ਘਰ ਵੇਹਲੇ ਹੁੰਦੀ ਹਾਂ ਤਾਂ ਮੇਰੇ ਘਰਦੇ ਕਹਿੰਦੇ ਆ ਕਿ ਅੱਜ ਤੂੰ ਹੀ ਖਾਣਾ ਬਣਾ ਅਤੇ ਮੈਨੂੰ ਪਕੌੜੇ ਬਣਾਉਣ ਦਾ ਵੀ ਬਹੁਤ ਹੀ ਵਧੀਆ ਸ਼ੌਂਕ ਹੈ ਅਤੇ ਮੈਂ ਬਹੁਤ ਵਧੀਆ ਬਣਾਉਂਦੀ ਹਾਂ ਮੇਰੇ ਘਰਦੇ ਵੀ ਬਹੁਤ ਖੁਸ਼ ਹੁੰਦੇ ਆ ਖਾ ਕੇ ਅਤੇ ਮੈਂ ਕਾਫੀ ਚੀਜ਼ਾਂ ਬਣਾ ਲੈਂਦੀ ਹਾਂ ਅਤੇ ਪਕਾਉਣ 'ਚ ਵੀ ਬਹੁਤ ਵਧੀਆ ਮੈਨੂੰ ਸ਼ੌਂਕ ਹੈ ਅਤੇ ਰੋਟੀ ਮੈਂ ਤਵੇ 'ਤੇ ਬਣਾ ਲੈਂਦੀ ਹਾਂ ਅਤੇ ਜਦ ਕੋਈ ਸਬਜ਼ੀ ਵਗੈਰਾ ਬਣਾਉਂਦੀ ਹਾਂ ਤਾਂ ਉਹਨੂੰ ਵੀ ਕੜਾਈ ਚੇ ਬਣਾਉਂਦੀ ਹਾਂ ਖਾਣਾ ਖਾਣਾ ਬਣਾਉਂਦੇ ਟਾਈਮ ਮੈਨੂੰ ਬਹੁਤ ਹੀ ਵਧੀਆ ਲੱਗਦਾ ਏ ਅਤੇ ਮੇਰੇ ਘਰਦੇ ਕਹਿੰਦੇ ਆ ਕਿ ਅੱਜ ਤੂੰ ਬਣਾ ਲੈ ਤੇ ਮੈਂ ਉਸ ਦਿਨ ਆਪ ਬਣਾ ਲੈਂਦੀ ਹਾਂ ਅਤੇ ਬਹੁਤ ਜ਼ਿਆਦਾ ਮੈਨੂੰ ਸ਼ੌਂਕ ਵੀ ਹੈ ਅਤੇ ਮੈਂ ਘਰਦਿਆਂ ਨੂੰ ਕਹਿੰਦੀ ਆ ਕਿ ਅੱਜ ਮੇਰੀ ਛੁੱਟੀ ਹੈ ਮੈਂ ਹੀ ਬਣਾ ਲੈਂਦੀ ਹਾਂ ਅਤੇ ਜਿਸ ਦਿਨ ਜ਼ਿਆਦਾ ਛੁੱਟੀ ਹੁੰਦਾ ਉਸ ਦਿਨ ਮੈਗੀ ਵਗੈਰਾ ਵੀ ਕੜਾਈ 'ਚ ਅਸੀਂ ਬਣਾ ਲੈਂਦੇ ਹਾਂ ਅਤੇ ਜਿੱਦਾਂ ਅਸੀਂ ਆਮ ਤੌਰ 'ਤੇ ਕੱਟਲਰੀ ਚਮਚੇ ਦੀ ਵੀ ਵਰਤੋਂ ਕਰਦੇ ਆ ਅਤੇ ਇਸ ਦੀ ਵਰਤੋਂ ਜਿੱਦਾਂ ਅਸੀਂ ਮੈਗੀ ਬਣਾਏ ਅਤੇ ਮੈਗੀ ਖਾਣ ਲਈ ਵੀ ਵਰਤ ਹੁੰਦੀ ਹੈ